ਚਿੱਤਰਕਾਰੀ ਇੱਕ ਅਜਿਹੀ ਕਲਾ ਹੈ ਜਿਸ ਨੂੰ ਅਭਿਆਸ ਦੇ ਨਾਲ ਹੋਰ ਸੁਧਾਰਿਆ ਅਤੇ ਨਿਖਾਰਿਆ ਜਾ ਸਕਦਾ ਹੈ ਚਿੱਤਰਕਾਰੀ ਦੀ ਸ਼ੁਰੂਆਤ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਚਿੱਤਰਕਾਰੀ ਵਿੱਚ ਮੁੱਢਲੇ ਆਕਾਰਾਂ ਦੀ ਚਿੱਤਰਕਾਰੀ ਤੋਂ ਸ਼ੁਰੂਆਤ ਕਰੇ ਜੇਕਰ ਉਸਨੂੰ ਮੁੱਢਲੇ ਆਕਾਰਾਂ ਦੀ ਚਿੱਤਰਕਾਰੀ ਚੰਗੀ ਤਰ੍ਹਾਂ ਆ ਜਾਵੇਗੀ ਅਤੇ ਉਸਦਾ ਚੰਗਾ ਅਭਿਆਸ ਹੋਵੇਗਾ ਤਾਂ ਉਸ ਲਈ ਵੱਡੀ ਤੋਂ ਵੱਡੀ ਅਤੇ ਗੁੰਝਲਦਾਰ ਚਿੱਤਰਕਾਰੀ ਕਰਨਾ ਵੀ ਆਸਾਨ ਹੋ ਜਾਵੇਗਾ ਇਸ ਤੋਂ ਇਲਾਵਾ ਉਸਨੂੰ ਚੰਗੇ ਰੰਗਾਂ ਅਤੇ ਚੰਗੇ ਸਪਲਾਈ ਸਟੇਸ਼ਨਰੀ ਦੀ ਗਿਆਨ ਹੋਣਾ ਵੀ ਜ਼ਰੂਰੀ ਹੈ ਉਸਨੂੰ ਪਤਾ ਹੋਣਾ ਚਾਹੀਦਾ ਹੈ ਕੀ ਕਿਸ ਚਿੱਤਰਕਾਰੀ ਵਿੱਚ ਕਿਸ ਤਰ੍ਹਾਂ ਦੇ ਰੰਗ ਅਤੇ ਕਿਸ ਤਰ੍ਹਾਂ ਦੀਆਂ ਪੈਨਸਲਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ